ਹਾਂਜੀ ਮੈਂ ਹੁਣ ਵੀ ਰਨਿੰਗ ਵਰਕ ਆਊਟ ਕਰਦਾ ਹਾਂ ਸਵੇਰ ਦੀ ਸੈਰ ਦੇ ਨਾਲ ਨਾਲ ਦੌੜਦੇ ਵੀ ਹਾਂ ਅਤੇ ਕਸਰਤ ਵੀ ਕਰਦੇ ਹਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਤਰੋ ਤਾਜ਼ਾ ਮਹਿਸੂਸ ਹੁੰਦਾ ਹੈ ਤੰਦਰੁਸਤ ਰਹਿੰਦਾ ਹੈ ਅਤੇ ਜੋ ਵੀ ਆਦਮੀ ਸਵੇਰੇ ਸੈਰ ਕਰਦਾ ਹੈ ਦੌੜਨ ਜਾਂਦਾ ਹੈ ਉਸ ਨੂੰ ਕਦੇ ਵੀ ਕਿਸੇ ਚੀਜ਼ ਦੀ ਬਿਮਾਰੀ ਦੀ ਨਹੀਂ ਕੋਈ ਸ਼ੰਕਾ ਰਹਿੰਦੀ ਨਾ ਹੀ ਕੋਈ ਉਹਨੂੰ ਮੈਡੀਸਨ ਲੈਣੀ ਪੈਂਦੀ ਹੈ ਸੈਰ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਸਾਡੇ ਸਰੀਰ ਨੂੰ ਤਰੋ ਤਾਜ਼ਾ ਤੰਦਰੁਸਤ ਰੱਖਦੀ ਹੈ ਅਤੇ ਦੌੜਨ ਦੇ ਨਾਲ ਨਾਲ ਸਰੀਰ ਵਿੱਚ ਫੁਰਤੀ ਰਹਿੰਦੀ ਹੈ ਇਸ ਨਾਲ ਸਾਡੇ ਸਰੀਰ ਨੂੰ ਵਧੀਆ ਗਰੋਥ ਹੁੰਦੀ ਹੈ ਅਤੇ ਭੁੱਖ ਵੀ ਵਧੀਆ ਲੱਗਦੀ ਹੈ ਸੈਰ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਸਾਡਾ ਸਰੀਰ ਫਿੱਟ ਰਹਿੰਦਾ ਹੈ ਇਸ ਨਾਲ ਅਸੀਂ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦੇ ਹਾਂ ਇਸ ਨਾਲ ਸਾਨੂੰ ਬਹੁਤ ਹੀ ਮਦਦ ਮਿਲਦੀ ਹੈ ਦੌੜਨ ਨਾਲ ਰਨਿੰਗ ਕਰਨ ਨਾਲ ਐਕਸਰਸਾਈਜ਼ ਕਰਨ ਨਾਲ ਸਾਡਾ ਸਰੀਰ ਬਿਲਕੁਲ ਫਿੱਟ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਰਨਿੰਗ ਇੱਕ ਐਸੀ ਚੀਜ਼ ਹੈ ਜੋ ਸਾਡੇ ਸਰੀਰ ਵਾਸਤੇ ਬਹੁਤ ਹੀ ਲਾਭਦਾਇਕ ਹੈ ਰਨਿੰਗ ਕਰਨ ਦੇ ਨਾਲ ਨਾਲ ਜਿਵੇਂ ਸਾਡੀ ਬੋਡੀ ਬਣਦੀ ਹੈ ਤਾਂ ਉਸ ਤਰ੍ਹਾਂ ਸਾਡੇ ਸਰੀਰ ਦੇ ਮਸਲ ਵੀ ਅ ਗੇਨ ਹੁੰਦੇ ਹਨ ਸਾਨੂੰ ਵਧੀਆ ਐਨਰਜੀ ਮਿਲਦੀ ਹੈ ਜੋ ਕਿ ਹਰ ਇੱਕ ਨੂੰ ਸਵੇਰੇ ਉੱਠਣ ਸਾਰ ਸੈਰ ਅਤੇ ਅਤੇ ਆਪਣੇ ਸਰੀਰ ਮੁਤਾਬਿਕ ਕਸਰਤ ਕਰਨੀ ਚਾਹੀਦੀ ਹੈ ਧੰਨਵਾਦ